ਪੰਜਾਬੀ ਇੱਕ ਇੰਡੋ ਆਰੀਅਨ ਭਾਸ਼ਾ ਹੈ ਜੋ ਦੁਨੀਆਂ ਭਰ ਵਿੱਚ ਸੌ ਮਿਲੀਅਨ ਤੋਂ ਵੱਧ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਮੁੱਖ ਤੌਰ 'ਤੇ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇਹ ਭਾਰਤ ਦੇ ਪੰਜਾਬ ਹਰਿਆਣਾ ਅਤੇ ਦਿੱਲੀ ਰਾਜਾਂ ਦੀ ਸਰਕਾਰੀ ਭਾਸ਼ਾ ਹੈ ਨਾਲ ਹੀ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰੀ ਭਾਸ਼ਾ ਹੈ ਪੰਜਾਬੀ ਦੁਨੀਆਂ ਭਰ ਦੇ ਡਾਈਸਪੋਰਾ ਭਾਈਚਾਰਿਆਂ ਵਿੱਚ ਵੀ ਵਿਆਪਕ ਤੌਰ 'ਤੇ ਬੋਲੀ ਜਾਂਦੀ ਹੈ ਖਾਸ ਤੌਰ 'ਤੇ ਯੂਨਾਈਟਡ ਕਿੰਗਡਮ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿੱਚ ਤੁਹਾਡੀ ਮਾਂ ਬੋਲੀ ਵਿੱਚ ਸਿੱਖਿਆ ਪ੍ਰਾਪਤ ਕਰਨਾ ਸਿੱਖਣ ਲਈ ਇਹ ਵਧੀਆ ਅਤੇ ਕੁਸ਼ਲ ਹੈ ਭਾਵੇਂ ਕਿ ਤਕਨੀਕੀ ਵਿਸ਼ਿਆਂ ਵਿੱਚ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਵਿਆਖਿਆ ਮਾਤ ਭਾਸ਼ਾ ਵਿੱਚ ਹੋ ਸਕਦੀ ਹੈ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰ ਰਹੇ ਡਾਈਸਪੂਰਾ ਲਈ ਰਾਜ ਦੀ ਸਰਪ੍ਰਸਤੀ ਜਾਂ ਸੰਸਥਾਵਾਂ ਹੋਣਾ ਵੀ ਸਿਹਤਮੰਦ ਹੈ ਉਦਾਹਰਣ ਲਈ ਸਾਡੇ ਕੋਲ ਪੰਜਾਬੀ ਵਿੱਚ ਕੋਈ ਸਿੱਖਿਆ ਨਹੀਂ ਹੈ ਪਰ ਸਿਰਫ ਇਸ ਨੂੰ ਬੋਲ ਸਕਦੇ ਹਾਂ ਇਸ ਲਈ ਜੇਕਰ ਪਟਿਆਲਾ ਯੂ ਪੰਜਾਬੀ ਯੂਨੀਵਰਸਿਟੀ ਮੌਜੂਦ ਨਾ ਹੁੰਦੀ ਤਾਂ ਮੈਂ ਉਹਨਾਂ ਨੂੰ ਪੰਜਾਬੀ ਸਿੱਖਣ ਲਈ ਡਿਕਸ਼ਨਰੀ ਅਨੁਵਾਦ ਲਿਪੀ ਅੰਤਰਣ ਅਤੇ ਵਰਡ ਪ੍ਰੋਸੈਸਿੰਗ ਟੂਲਸ ਤੱਕ ਪਹੁੰਚ ਕਰ ਦੇ ਯੋਗ ਨਹੀਂ ਹੁੰਦਾ ਇਹ ਸਭ ਖਿਆਲ ਵਿੱਚ ਨਹੀਂ ਕੀਤਾ ਜਾ ਸਕਦਾ ਇਸ ਲਈ ਫੀਡਿੰਗ ਦੀ ਲੋੜ ਹੈ ਕਈ ਸਾਲਾਂ ਜਾਂ ਇਥੋਂ ਤੱਕ ਕਿ ਪੀੜ੍ਹੀਆਂ ਅਤੇ ਪੂਰੇ ਸਮੇਂ ਦੇ ਕਰਮਚਾਰੀਆਂ ਦੀ ਅਤੇ ਨਾ ਹੀ ਇਹ ਕੋਈ ਆਸਾਨ ਕੰਮ ਹੈ ਭਾਰਤ ਵਰਗੀਆਂ ਫੈਡਰੇਸ਼ਨਾਂ ਜਾਂ ਯੂਨੀਅਨਾਂ ਵਿੱਚ ਇਹ ਉਦੋਂ ਤੱਕ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਭਾਸ਼ਾ ਅਧਿਕਾਰਿਕ ਸਮਰੱਥਾ ਨਾ ਹੋਵੇ ਉਨੱਤ ਸਾਖਰਤਾ ਦੇ ਆਧੁਨਿਕ ਯੁੱਗ ਵਿੱਚ ਪਹਿਲੀਆਂ ਪੀੜ੍ਹੀਆਂ ਦੇ ਮੁਕਾਬਲੇ ਸਰਕਾਰੀ ਸਰਪਰਸਤੀ ਤੋਂ ਬਿਨਾਂ ਭਾਸ਼ਾਵਾਂ ਬਹੁਤ ਤੇਜ਼ੀ ਨਾਲ ਖਤਮ ਹੋ ਜਾਣਗੀਆਂ ਜਦੋਂ ਸਿਰਫ ਕੁਲੀਨ ਵਰਗ ਹੀ ਸਹੀ ਸਿੱਖਿਆ ਦੇ ਸਕਦਾ ਹੋਵੇ